ਹੈਲੋ ਹਾਂਜੀ ਮੈਂ ਫਲਿਪਕਾਰਟ 'ਚ ਫੋਨ ਕੀਤਾ ਹੈ ਮੈਂ ਆਪਣਾ ਕਿਚਨ ਕੰਟੇਨਰ ਤੁਹਾਡੇ ਕੋਲ ਆਰਡਰ ਕੀਤੇ ਸੀ ਅਤੇ ਮੇਰਾ ਕਿਚਨ ਕੰਟੇਨਰ ਇੱਕ ਤਾਂ ਬਹੁਤ ਲੇਟ ਆਇਆ ਮੇਰਾ ਪ੍ਰੋਡਕਟ ਟਾਈਮ ਸਿਰ ਡਿਲੀਵਰੀ ਨਹੀਂ ਹੋਈ ਉਹਦੀ ਔਰ ਅਗਰ ਪ੍ਰੋਡਕਟ ਘਰ ਆਏ ਵੀ ਹੈ ਤਾਂ ਮੈਂ ਕਲਰ ਚੂਜ ਕੀਤਾ ਸੀ ਗਰੀਨ ਔਰ ਮੇਰੇ ਕੋਲ ਕਲਰ ਆ ਗਿਆ ਬਲੈਕ ਔਰ ਉਹਨਾਂ ਦੀ ਕੁਆਲਿਟੀ ਇੰਨੀ ਕੁ ਗੰਦੀ ਹੈ ਇੰਨੀ ਕੁ ਡਲ ਕੁਆਲਿਟੀ ਦੇ ਆਏ ਆ ਨਾ ਕਿ ਮੈਂ ਸੋਚਿਆ ਨਹੀਂ ਸੀ ਕਿ ਕਦੇ ਕਿ ਇਸ ਤਰ੍ਹਾਂ ਦੀ ਚੀਜ਼ ਵੀ ਆ ਸਕਦੀ ਆ ਮਤਲਬ ਕਿ ਜੋ ਦੇਖਿਆ ਸੀ ਉਹ ਚੀਜ਼ ਨਹੀਂ ਆਈ ਉਸ ਤੋਂ ਵੀ ਮਤਲਬ ਕਿ ਉਹ ਚੀਜ਼ ਦੇਖਣ 'ਚ ਕੁਛ ਔਰ ਸੀ ਔਰ ਜੋ ਚੀਜ਼ ਮੇਰੇ ਕੋਲ ਆਈ ਹੈ ਉਹ ਚੀਜ਼ ਕੁਛ ਔਰ ਸੀ ਬਹੁਤ ਹੀ ਗੰਦਾ ਪ੍ਰੋਡਕਟ ਮੇਰੇ ਕੋਲ ਆਇਆ ਤੁਹਾਡੀ ਤੁਹਾਡੀ ਇਸ ਸਰਵਿਸ ਤੋਂ ਮਤਲਬ ਕਿ ਅਸੀਂ ਖੁਸ਼ ਨਹੀਂ ਹਾਂ ਅਗਰ ਤੁਸੀਂ ਇਸ ਤਰਾਂ ਹੀ ਸਰਵਿਸ ਕਰੋਗੇ ਤਾਂ ਤੁਹਾਡਾ ਕੁਛ ਉਹ ਨਹੀਂ ਹੈ ਦੇਖੋ ਹੁਣ ਤੁਹਾਡਾ ਆਇਆ ਸੀ ਡਿਲੀਵਰੀ ਬੋਆਏ ਉਹਨੇ ਸਾਡੇ ਕੋਲ ਐਕਸਟਰਾ ਚਾਰਜਸ ਵੀ ਲਿੱਤੇ ਤੁਸੀਂ ਮਨ ਮਤਲਬ ਕਿ ਉਹਦੇ ਵਿੱਚ ਸਿਰਫ਼ ਸਾਨੂੰ ਤੁਸੀਂ ਐਕਸਟਰਾ ਚਾਰਜਿਸ ਵਗੈਰਾ ਕੁਛ ਨਹੀਂ ਪੇ ਕਰਨ ਨੂੰ ਕਿਹਾ ਸੀ ਪਰ ਉਹਨੇ ਐਕਸਟਰਾ ਚਾਰਜਿਸ ਵੀ ਸਾਡੇ ਕੋਲੋਂ ਪੇ ਲਿੱਤੇ ਔਰ ਅਦਰਵਾਈਜ਼ ਉਹਨੇ ਜੋ ਪ੍ਰੋਡਕਟ ਦਿੱਤਾ ਪ੍ਰੋਡਕਟ ਦੇਖ ਕੇ ਇਨਾਂ ਕੁ ਦੁੱਖ ਹੋਇਆ ਨਾ ਕਿ ਦਿਖਾਉਂਦੇ ਕੁਛ ਹੋ ਔਰ ਤੁਸੀਂ ਭੇਜਦੇ ਕੁਛ ਹੋ ਇਹ ਤਾਂ ਬਹੁਤ ਹੀ ਗਲ਼ਤ ਹੁੰਦਾ ਕਸਟਮਰ ਨਾਲ ਦੇਖੋ ਜੀ ਬਸ ਓਕੇ